ਹੈਲੋ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਮੈਂ ਪਹੁੰਚ ਗਈ ਘਰ ਹਾਂਜੀ ਮੈਮ ਪਤਾ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਮ ਕੰਮ ਤੁਸੀਂ ਮੈਨੂੰ ਦੱਸ ਦਿਓ ਮੈਂ ਉਹ ਹੀ ਤਿਆਰ ਕਰ ਦੇਵਾਂਗੀ ਜਿਹੜਾ ਸਮਾਨ ਘਰ ਆਵੇਬਲ ਹੈਗਾ ਉਹ ਦੱਸ ਦਿਓ ਤੁਸੀਂ ਮੈਨੂੰ ਉਹ ਵਾਲਾ ਕੰਮ ਮੈਂ ਪਹਿਲਾਂ ਕਰਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਕਰ ਦਿੰਦੀ ਹਾਂ ਮੈਮ ਮੈਮ ਸਮਾਨ ਡੈਕੋਰੇਸ਼ਨ ਦਾ ਕਿੱਥੇ ਪਿਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਮੈਮ ਡੈਕੋਰੇਸ਼ਨ ਬਾਹਰ ਲੋਬੀ 'ਚ ਹੀ ਕਰਨੀ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਖਾਣਾ ਪੀਣਾ ਮੈਮ ਤੁਸੀਂ ਮੈਨੂੰ ਦੱਸ ਦਿਓ ਇੱਕ ਤਾਂ ਆਪਾਂ ਚਨੇ ਅਤੇ ਭਟੂਰੇ ਕਰ ਲਵਾਂਗੇ ਹਾਂਜੀ ਪਰ ਚਨੇ ਮੈਮ ਤੁਸੀਂ ਕੀਤੇ ਹੋਏ ਆ ਭਿਓਂਤੇ ਹੀ ਕਿ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਮੈਮ ਤੁਸੀਂ ਮੈਨੂੰ ਟਾਈਮਿੰਗ ਦੱਸੋ ਕਿੰਨੇ ਕੁ ਵਜੇ ਹੈ ਮਤਲਬ ਪਾਰਟੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਸਪੈਸ਼ਲ ਕੀ ਮੈਮ ਤੁਸੀਂ ਦੱਸ ਦਿਓ ਵੀ ਕੀ ਫੇਵਰੇਟ ਹੈ ਮੈਂ ਉਹ ਹੀ ਬਣਾ ਲਵਾਂਗੀ ਹਾਂਜੀ ਮੈਮ ਕਰ ਲਵਾਂਗੀ ਹਾਂਜੀ ਠੀਕ ਹੈ ਹੋਰ ਹੋਰ ਮੈਮ ਬੱਚਿਆਂ ਵਾਸਤੇ ਕੁਝ ਸਪੈਸ਼ਲ ਚੀਜ਼ ਬਣਾਉਣੀ ਹੋਵੇ ਹਾਂਜੀ ਮੈਮ ਅਤੇ ਹੋਰ ਮੈਮ ਕੋਈ ਕੋਲਡ ਡਰਿੰਕਸ ਵਗੈਰਾ ਜਾਂ ਫਿਰ ਕੁਛ ਹੋਰ

ਠੀਕ ਐ ਠੀਕ ਐ ਓਕੇ ਓਕੇ ਮੈਮ ਜਲਦੀ ਆ ਜਿਓ ਫਿਰ ਤੁਸੀਂ ਓਕੇ ਮੈਮ